ਮੇਰੇ ਕੋਲ ਮਨਪਸੰਦ ਕਲਾ ਹੱਥ ਦੀ ਕਢਾਈ ਹੈ ਜਿਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਇਸ ਨਾਲ ਕਈ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਹਨ ਅਤੇ ਇਸ ਨੂੰ ਇਸ ਨੂੰ ਕਰਨਾ ਇਸ ਨੂੰ ਕਰਨਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਇਹ ਇੱਕ ਕਿਸ ਇੱਕ ਕਿਸਮ ਦਾ ਰੁਜ਼ਗਾਰ ਵੀ ਹੈ ਮੈਂ ਅੱਗੇ ਇਸਦੀ ਹੀ ਪੜ੍ਹਾਈ ਕਰ ਰਹੀ ਹਾਂ ਅਤੇ ਇਸ ਵਿੱਚ ਮੇਰੇ ਮੇਰੇ ਮਨਪਸੰਦ ਕਲਾਕਾਰ ਮੇਰੇ ਮਾਤਾ ਜੀ ਜਿਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ